ਹੈਲੋ ਸਰ ਮੈਂ ਐਕਚੁਲੀ ਫਲਿਪਕਾਟ ਤੋਂ ਮੋਬਾਈਲ ਮੰਗਵਾਇਆ ਸੀ ਟਵੈਂਟੀ ਸਿਕਸ ਜਨਵਰੀ ਨੂੰ ਕਿ ਮਤਲਬ ਸੇਲ ਲੱਗੀ ਹੋਈ ਸੀ ਚਲੋ ਮੋਬਾਈਲ ਮੰਗਵਾਉਂਦੇ ਹਾਂ ਅਤੇ ਜਿਹੜਾ ਮੋਬਾਈਲ ਆਇਆ ਸੀ ਜਦੋਂ ਅਸੀਂ ਓਪਨ ਕੀਤਾ ਹੈ ਤਾਂ ਉਹ ਮੋਬਾਈਲ ਬਿਲਕੁਲ ਹੀ ਮਤਲਬ ਖਰਾਬ ਜਿਹਾ ਨਿਕਲਿਆ ਉਹ ਜਿਹੜੀ ਉਹਦੀ ਮਤਲਬ ਅਨਬੋਕਸਿੰਗ ਸੀ ਉਹ ਵੀ ਮਤਲਬ ਖਰਾਬ ਸੀ ਜਿਹੜਾ ਡਿਲੀਵਰੀ ਬੋਅਏ ਦੇਣ ਵੀ ਆਇਆ ਸੀ ਉਹਦਾ ਵੀ ਬਿਹੇਵੀਅਰ ਬਹੁਤ ਜ਼ਿਆਦਾ ਗਲਤ ਸੀ ਅਤੇ ਅਸੀਂ ਚਲੋ ਇਸ ਕਰਕੇ ਮੰਗਵਾਇਆ ਸੀ ਚਲੋ ਸੇਲ ਲੱਗੀ ਹੋਈ ਹੈ ਫਲਿੱਪਕਾਡ 'ਤੇ ਅਤੇ ਚਲੋ ਮੋਬਾਇਲ ਮੰਗਵਾਉਂਦੇ ਹਾਂ ਬਟ ਨਹੀਂ ਮੋਬਾਇਲ ਬਹੁਤ ਜ਼ਿਆਦਾ ਖਰਾਬ ਨਿਕਲਿਆ ਅਤੇ ਸਾਨੂੰ ਬਹੁਤ ਜ਼ਿਆਦਾ ਮਹਿੰਗਾ ਵੀ ਪਿਆ ਹੈ ਅਸੀਂ ਤਾਂ ਸਸਤੇ ਕਰਕੇ ਮੰਗਵਾਇਆ ਸੀ ਬਟ ਬਹੁਤ ਜ਼ਿਆਦਾ ਮਹਿੰਗਾ ਵੀ ਪਿਆ ਜਿਹੜਾ ਪ੍ਰੋਡਕਟ ਉਹ ਵੀ ਬਿਲਕੁਲ ਖਰਾਬ ਜਿਹਾ ਨਿਕਲਿਆ ਅਤੇ ਜਿਹੜੀ ਨਾਲ ਅਸੈਸਰੀ ਹੁੰਦੀ ਹੈ ਉਹ ਵੀ ਨਹੀਂ ਤੁਸੀਂ ਬਿਲਕੁਲ ਵੀ ਨਾਲ ਨਹੀਂ ਸੀ ਹੈਗੀ ਨਾ ਹੀ ਚਾਰਜਰ ਸੀ ਨਾ ਹੀ ਹੈਡਫੋਨ ਸੀ ਅਤੇ ਜਿਹੜੀ ਉਹਦੀ ਮਤਲਬ ਡੱਬਾ ਸੀ ਜਿਹੜਾ ਬੋਕਸਿੰਗ ਸੀ ਉਹ ਵੀ ਬਿਲਕੁਲ ਬੰਦ ਮਤਲਬ ਹੋਰ ਹੀ ਤਰ੍ਹਾਂ ਦਾ ਮਤਲਬ ਖੁੱਲ੍ਹਾ ਹੋਇਆ ਸੀ ਜਿਵੇਂ ਕਿਸੇ ਨੇ ਯੂਜ ਕੀਤਾ ਹੋਵੇ ਤਾਂ ਇਹ ਜਿਹੜਾ ਫੋਨ ਆ ਬਿਲਕੁਲ ਖਰਾਬ ਨਿਕਲਿਆ ਸਾਡਾ ਜਿਹੜੇ ਪੈਸੇ ਸੀ ਸਾਡੇ ਹੋਰ ਵੀ ਜ਼ਿਆਦਾ ਲੱਗ ਗਏ ਜੋ ਕਿ ਵੇਸਟ ਹੋ ਗਏ ਨੇ ਸਾਨੂੰ ਇੱਥੋਂ ਵੀ ਖਰੀਦਣਾ ਪਿਆ ਹੁਣ ਤਾਂ ਇਸ ਕਰਕੇ ਜਿਹੜਾ ਇਹ ਜਿਹੜਾ ਪ੍ਰੋਡਕਟ ਲਿਆ ਬਹੁਤ ਜ਼ਿਆਦਾ ਗਲਤ ਨਿਕਲਿਆ ਖਰਾਬ ਨਿਕਲਿਆ ਥੈਂਕ ਯੂ